ਯੋਗਾ ਅਤੇ ਸਰੀਰਕ ਕਸਰਤ ਬਹੁਤ ਹੀ ਜ਼ਰੂਰੀ ਹਨ ਯੋਗਾ ਸੁਣ ਵਿੱਚ ਆਉਂਦਾ ਹੈ ਕਿ ਆਤਮਿਕ ਸ਼ਾਂਤੀ ਅਤੇ ਮਨੋਬਲ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰਕ ਕਸਰਤ ਆਮ ਤੌਰ 'ਤੇ ਸਰੀਰ ਦੇ ਹਰ ਇੱਕ ਤਰ੍ਹਾਂ ਦੇ ਅੰਗ ਜਿਵੇਂ ਕਿ ਡੌਲੇ ਪੱਟ ਅਤੇ ਗਰਦਨ ਛਾਤੀ ਪੈਰਾਂ ਨੂੰ ਮਜ਼ਬੂਤ ਕਰਦੀ ਹੈ ਇਹ ਦੋਨੇ ਚੀਜ਼ਾਂ ਵੱਖ ਹਨ ਪਰ ਕਿਤੇ ਨਾ ਕਿਤੇ ਚੀਜ਼ਾਂ ਇੱਕ ਦੂਜੇ ਦੇ ਨਜ਼ਦੀਕ ਹੀ ਹਨ ਅਤੇ ਦੋਨਾਂ ਨੂੰ ਅਲੱਗ ਅਲੱਗ ਕਰਨ ਦੇ ਢੰਗ ਹਨ ਅਤੇ ਕਰਦੇ ਰਹਿਣਾ ਚਾਹੀਦਾ ਹੈ ਸਰੀਰਕ ਕਸਰਤ ਆਮ ਤੌਰ 'ਤੇ ਬਚਪਨ ਤੋਂ ਹੀ ਸਟਾਰਟ ਹੁੰਦੀ ਜਾਂਦੀ ਹੈ ਅਤੇ ਇਸ ਨੂੰ ਕਰਨ ਨਾਲ ਬੰਦਾ ਬਹੁਤ ਜ਼ਿਆਦਾ ਲੰਮੀ ਜ਼ਿੰਦਗੀ ਅਤੇ ਤੰਦਰੁਸਤ ਜ਼ਿੰਦਗੀ ਜਿਉਂਦਾ ਹੈ ਅਗਰ ਯੋਗੇ ਦੀ ਗੱਲ ਕਰੀਏ ਅਤੇ ਰਾਮਦੇਵ ਵਰਗੇ ਬਹੁਤ ਸਾਰੇ ਵਿਗਿਆਨੀ ਜਾਂ ਗਿਆਨੀ ਇਨਸਾਨ ਇਸ ਨੂੰ ਇੱਕ ਬਹੁਤ ਵੱਡੇ ਪੱਧਰ 'ਤੇ ਲੈ ਕੇ ਗਏ ਹਨ ਜਿਸ ਨੂੰ ਕਿ ਭਾਰਤ ਦੇ ਹਰ ਇੱਕ ਖੇਤਰ ਵਿੱਚ ਯੋਗਾ ਨੂੰ ਕੀਤਾ ਜਾਂਦਾ ਹੈ ਅਤੇ ਇਸ ਨਾਲ ਆਤਮਿਕ ਸ਼ਕਤੀ ਬਹੁਤ ਜ਼ਿਆਦਾ ਵੱਧਦੀ ਹੈ ਅਤੇ ਸਰੀਰਕ ਊਰਜਾ ਵਿੱਚ ਵੀ ਵਾਧਾ ਹੁੰਦਾ ਹੈ ਇਹ ਕਰਦੇ ਰਹਿਣ ਨਾਲ ਆਦਮੀ ਵੀ ਬਹੁਤ ਜ਼ਿਆਦਾ ਸਰੀਰਕ ਜ਼ਿੰਦਗੀ ਲੰਬੀ ਜਿਊਂਦਾ ਹੈ